ਤਰਨਤਾਰਨ ਜ਼ਿਲ੍ਹੇ ਵਿੱਚ ਮੁੱਖ ਕੁਦਰਤੀ ਸਰੋਤ ਬਰਸਾਤ ਹੈ ਅਤੇ ਸਾਨੂੰ ਵਾਤਾਵਰਣ ਸੰਬੰਧੀ ਕੁਛ ਜ਼ਿਆਦਾ ਖਾਸ ਚੁਣੌਤੀਆਂ ਨਹੀਂ ਵਾਪਰਦੀਆਂ ਕਿਉਂਕਿ ਆਪਣੇ ਇੱਥੇ ਕਾਫ਼ੀ ਸਹੂਲਤਾਂ ਆ ਹੈਗੀਆਂ ਹਨ ਅਤੇ ਸਾਡੇ ਜ਼ਿਲ੍ਹੇ ਵਿੱਚ ਪਾਣੀ ਦੇ ਸਰੋਤ ਜਿਵੇਂ ਆਪਾਂ ਨਲਕਾ ਵਗੈਰਾ ਕਹਿ ਸਕਦੇ ਹਾਂ ਅਤੇ ਇਹ ਏ ਸਮਰਸੀਬਲ ਆਪਾਂ ਯੂਜ਼ ਕਰਦੇ ਹਾਂ ਅਤੇ ਜਿਹੜਾ ਸਰਕਾਰੀ ਤੌਰ 'ਤੇ ਆਪਾਂ ਨੂੰ ਟੂਟੀਆਂ ਰਾਹੀਂ ਪਾਣੀ ਪ੍ਰਾਪਤ ਹੁੰਦਾ ਹੈਗਾ ਹੈ ਅਤੇ ਕੋਈ ਵੀ ਜੋ ਬਦਲਾਵ ਹੈਗਾ ਜੋ ਸਫ਼ਾਈ ਦੇ ਬਾਰੇ 'ਚ ਸਾਡੀ ਨਗਰਪਾਲਿਕਾ ਵੱਲੋਂ ਤਰਨਤਾਰਨ ਦੀ ਸਫ਼ਾਈ ਦਾ ਕਾਫ਼ੀ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸਾਰੇ ਪਾਸੇ ਆਪਣੇ ਤਰਨਤਾਰਨ ਨੂੰ ਪ੍ਰਦੂਸ਼ਣ ਰਹਿਤ ਅਤੇ ਸਾਫ਼ ਸਫ਼ਾਈ ਦੇ ਤੋਰ 'ਤੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਇਸ ਸ਼ਹਿਰ ਨੂੰ ਊ ਸਜਾਇਆ ਜਾ ਰਿਹਾ ਹੈ